ਹੈਲੋ ਵਧੀਆ ਅਮਨ ਕੀ ਹਾਲ ਚਾਲ ਕੀ ਹਾਲ ਕਿੱਥੇ ਹੋ ਅੱਜ ਕੱਲ੍ਹ ਅੱਛਾ ਅੱਛਾ ਬਸ ਠੀਕ ਹੈ ਘਰ ਕਿੱਦਾਂ ਸਾਰੇ ਹਾਂਜੀ ਹਾਂਜੀ ਬੋਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਅਮਨ ਅਗਰ ਤੁਸੀਂ ਸ਼ਹਿਰ ਸ਼ਿਫਟ ਹੋ ਜਾਂਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਇਥੇ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਹਰ ਚੀਜ਼ ਤੁਹਾਨੂੰ ਡੋਰਸਟੈੱਪ 'ਤੇ ਆ ਚਾਹੇ ਤੁਸੀਂ ਰਾਤ ਨੂੰ ਬਾਹਰ ਹਾਂਜੀ ਹਾਂਜੀ ਤੁਸੀਂ ਚਾਹੇ ਰਾਤ ਨੂੰ ਬਾਹਰ ਨਿਕਲੋ ਅਮਨ ਦੇ ਦੇਖੋ ਤੁਸੀਂ ਅਗਰ ਸ਼ਹਿਰ ਚ ਇਥੇ ਸ਼ਿਫਟ ਕਰਦੇ ਹੋ ਬਹੁਤ ਬੈਨੀਫਿਟ ਆ ਇੱਕ ਤਾਂ ਜੋ ਪ੍ਰੋਬਲਮ ਤੁਸੀਂ ਦੱਸ ਰਹੇ ਹੋ ਤੁਹਾਨੂੰ ਫੇਸ ਨਹੀਂ ਕਰਨੀ ਪੈਣਗੀਆਂ ਦੂਜੀ ਗੱਲ ਹੈ ਕਿ ਤੁਸੀਂ ਵਧੀਆ ਕਿਸੇ ਇੰਸਟੀਟਿਊਟ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਜੋਬ ਲੱਗ ਸਕਦੇ ਹੋ ਤੁਹਾਡਾ ਬੱਚਾ ਵਧੀਆ ਸਕੂਲ 'ਚ ਪੜ੍ਹ ਸਕਦਾ ਆ ਤੁਹਾਨੂੰ ਫੈਸਿਲਿਟੀ ਜਿਹੜੀ ਆ ਡੋਸਪੈਕਟੇਪ ਹਰੇਕ ਮਿਲੇਗੀ ਤੁਹਾਨੂੰ ਪਿੰਡਾਂ ਦੀ ਤਰ੍ਹਾਂ ਨਾ ਦੂਰ ਦੂਰ ਮਾਰਕੀਟ ਜਾਣਾ ਨਹੀਂ ਪਏਗਾ ਕਿਸੇ ਚੀਜ਼ ਲਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਅਗਰ ਸ਼ਿਫਟ ਹੋਣਾ ਹੋਇਆ ਤਾਂ ਜ਼ਰੂਰ ਮੇਰੇ ਨਾਲ ਕੰਸਰਨ ਕਰਿਓ ਜਿੱਥੇ ਵੀ ਤੁਸੀਂ ਘਰ ਵਗੈਰਾ ਲੈਣਾ ਹੋਇਆ ਕਿਤੇ ਸੈਟਅਪ ਕੋਈ ਚਾਹੀਦਾ ਮੈਂ ਜ਼ਰੂਰ ਤੁਹਾਡੀ ਸਹਾਇਤਾ ਕਰੂੰਗੀ ਉਸ ਦੇ ਵਿੱਚ ਤੁਸੀਂ ਪੂਰੀ ਫੈਮਿਲੀ ਨੇ ਸ਼ਿਫਟ ਹੋਣਾ ਜਾਂ ਤੁਸੀਂ ਇਕੱਲੇ ਆਪਣੇ ਹਸਬੈਂਡ ਨਾਲ ਸ਼ਿਫਟ ਹੋਣਾ ਹਾਂਜੀ ਹਾਂਜੀ ਨਹੀਂ ਮੈਨੂੰ ਤਾਂ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਚਲੋ ਸਾਡੇ ਨੇੜੇ ਆ ਜਾਓਗੇ ਹਾਂਜੀ ਬਿਲਕੁਲ ਦੇਖੋ ਸ਼ਹਿਰ ਅਤੇ ਸ਼ਹਿਰ ਅਤੇ ਪਿੰਡ ਦੀ ਜ਼ਿੰਦਗੀ ਦੇ ਵਿੱਚ ਬਹੁਤ ਫ਼ਰਕ ਤਾਂ ਹੈਗਾ ਡਿਫਰੈਂਸ ਤਾਂ ਆਇਆ ਤੁਸੀਂ ਲੇਟ ਨਾਈਟ ਆ ਸਕਦੇ ਹੋ ਜਾ ਸਕਦੇ ਹੋ ਕਿਤੇ ਕੰਮ ਕਰਨਾ ਆ ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਹੋ ਜਾਂਦਾ ਮਾਹੌਲ ਇਸ ਤਰ੍ਹਾਂ ਦਾ ਆ ਕਿ ਤੁਹਾਨੂੰ ਸੌ ਚੀਜ਼ਾਂ ਦੇਖਣੀਆਂ ਪੈਂਦੀਆਂ ਹਰ ਚੀਜ਼ ਅਵੇਲੇਬਲ ਨਹੀਂ ਰਹਿੰਦੀ ਰਾਤ ਤੱਕ ਹਰ ਚੀਜ਼ ਦੀ ਉਪਲਬਧਤਾ ਲਈ ਸ਼ਹਿਰ ਤੁਹਾਡੇ ਲਈ ਬਹੁਤ ਜ਼ਿਆਦਾ ਇੱਕ ਸਹਾਇਕ ਪਰੂਫ ਹੋ ਜਾਂਦਾ ਆ ਹੈ ਨਾ ਚਲੋ ਜ਼ਰੂਰ ਜ਼ਰੂਰ ਹਾਂਜੀ ਕਦੀ ਵੀ ਹਾਂਜੀ ਕਦੀ ਵੀ ਲੋੜ ਹੋਈ ਕਦੀ ਵੀ ਕਾਲ ਕਰੋ ਤੁਸੀਂ ਆ ਵੀ ਜਾਇਓ ਆ ਕੇ ਦੇਖ ਵੀ ਲਈਓ ਠੀਕ ਹੈ ਓਕੇ ਬਾਏ ਬਾਏ